ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਉਭਰ ਰਹੀਆਂ ਟੈਕਨੋਲੋਜੀਆਂ ਜਿੱਦਾਂ ਕਿ ਆਰਟੀਫਿਸ਼ਅਲੀ ਇੰਟੈਲੀਜੈਂਸ ਜਾਂ ਵੈਬ ਥਰੀ ਟੈਕਨੋਲੋਜੀ ਜਾਂ ਕੁਆਟਮ ਕੰਪਿਊਟਿੰਗ ਜਾਂ ਐਜ ਕੰਪਿਊਟਿੰਗ ਇਹੋ ਜਿਹੀਆਂ ਟੈਕਨੋਲੋਜੀਆਂ ਦੇ ਵਿੱਚ ਰਿਸਰਚ ਉਹਦੇ ਜਿਹੜੇ ਇੰਸਟੀਟਿਊਟਸ ਹੈ ਜਿਵੇਂ ਕਿ ਆਈਆਈਟੀ ਜਾਂ ਐਨਆਈਟੀ ਜਾਂ ਹੋਰ ਰੀਜਨਲ ਕਾਲਜ ਇਹ ਸਭ ਉਸ ਦੇ ਵਿੱਚ ਭਾਲ ਕਰ ਰਹੇ ਆ ਉਸ ਦੇ ਵਿੱਚ ਨਵੀਆਂ ਨਵੀਆਂ ਖੋਜਾਂ ਕਰ ਰਹੇ ਹੈ ਨਵੇਂ ਨਵੀਆਂ ਟੈਕਨੋਲਜੀਆਂ ਵੀ ਬਣਾ ਰਹੇ ਹੈ ਜਿਵੇਂ ਕਿ ਆਰਟੀਫੀਸ਼ਿਅਲ ਇੰਟੈਲੀਜਸ ਹੈ ਉਹ ਨਵੇਂ ਨਵੇਂ ਚੈਟ ਬੋਟਸ ਬਣਾ ਰਿਹਾ ਤਾਂ ਉਹ ਸਾਰਾ ਕੁਛ ਜਿਹੜਾ ਹੈਗਾ ਗਾ ਉਹ ਟੈਕਨੋਲੋਜੀ ਸੈਕਟਰ ਦੇਖ ਰਿਹਾ ਹੁਣ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਆਪਾਂ ਸਿਰਫ ਆਪਾਂ ਹੁਣ ਆਪਾਂ ਜਦੋਂ ਆਪਾਂ ਸਾਰੇ ਕੰਮ ਆਪਣੇ ਕੰਪਿਊਟਰ ਤੋਂ ਕਰਾਇਆ ਕਰਾਂਗੇ